ਸਾਡੇ ਰਾਜ ਦੇ ਵਿੱਚ ਅਨੇਕਾਂ ਧਾਰਮਿਕ ਤਿਉਹਾਰ ਮਨਾਏ ਜਾਂਦੇ ਨੇ ਜਿਵੇਂ ਵਿਸਾਖੀ ਹੋ ਗਈ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਵਿਸਾਖੀ ਵਾਲੇ ਦਿਨ ਪੰਥ ਖਾਲਸਾ ਸਾਜਿਆ ਸੀ ਅਤੇ ਪੰਥ ਖਾਲਸੇ ਦੀ ਸਾਜਨਾ ਕਰੀ ਸੀ ਸੋਲ੍ਹਾਂ ਸੌ ਨੜਿਨਵੇਂ ਵਾਲੇ ਦਿਨ ਗੁਰੂ ਸਾਹਿਬ ਨੇ ਪੰਥ ਖਾਲਸਾ ਦੀ ਸਾਜਨਾ ਕੀਤੀ ਸੀ ਪੰਜ ਪਿਆਰੇ ਸਾਜੇ ਸੀ ਸੀਸ ਮੰਗਿਆ ਸੀ ਅਤੇ ਉਸ ਟਾਈਮ ਜਿਹੜੇ ਕਿਸਾਨ ਨੇ ਉਹ ਕਣਕਾਂ ਦੀ ਵਾਢੀ ਵਗੈਰਾ ਇਹ ਵੀ ਕਰਦੇ ਨੇ ਅਤੇ ਦੂਜਾ ਜਿਹੜਾ ਤਿਉਹਾਰ ਹੈ ਸਾਡਾ ਦੀਪਾਵਲੀ ਜਿੱਥੇ ਛੇਵੇਂ ਪਾਤਸ਼ਾਹ ਬੰਦੀ ਛੋੜ ਦਿਵਸ ਮਨਾਇਆ ਜਾਂਦਾ ਹੈ ਜਿਨ੍ਹਾਂ ਨੂੰ ਬੰਦੀ ਛੋੜ ਦਿਵਸ ਦੇ ਨਾਲ ਜਾਣਿਆ ਜਾਂਦਾ ਹੈ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਪੰਥ ਖਾਲਸਾ ਸਾਜਿਆ ਸੀ ਵਿਸਾਖੀ ਵਾਲੇ ਦਿਨ ਅਤੇ ਦੀਵਾਲੀ ਵਾਲੇ ਦਿਨ ਛੇਵੇਂ ਪਾਤਸ਼ਾਹ ਨੇ ਬੰਦੀ ਛੋੜ ਦਿਵਸ ਦੇ ਨਾਲ ਦੀਵਾਲੀ ਦਾ ਜਿਹੜਾ ਮੁੱਖ ਤਿਉਹਾਰ ਹੈ ਸਾਡਾ ਉਹ ਮਨਾਇਆ ਜਾਂਦਾ ਅਤੇ ਹੋਰ ਜਿਹੜਾ ਆਪਣਾ ਕ੍ਰਿਸਮਿਸ ਇਹ ਸਾਡੇ ਮਤਲਬ ਤਿਉਹਾਰ ਨਹੀਂ ਮਨਾਇਆ ਜਾਂਦਾ ਇਹਨੂੰ ਅਸੀਂ ਨਹੀਂ ਮਨਾਉਂਦੇ ਕਿਉਂਕਿ ਜਿਹੜੇ ਸਾਡੇ ਨਾਲ ਅਜ ਮੁੱਖ ਤਿਉਹਾਰ ਨੇ ਜਿਹੜੇ ਇੱਕ ਵਿਸਾਖੀ ਹੈ ਅਤੇ ਹੋਰ ਦੀਪਾਵਲੀ ਹੈ ਇਹ ਗੁਰੂ ਸਾਹਿਬ ਦੇ ਅਨੁਸਾਰ ਹੀ ਸਾਡੇ ਜਿਹੜੇ ਪ੍ਰਸਿੱਧ ਤਿਉਹਾਰ ਮਨਾਏ ਜਾਂਦੇ ਨੇ